ਸਾਡੇ ਸਮਾਜ ਵਿੱਚ ਕਈ ਤਰ੍ਹਾਂ ਦੀ ਕਲਾ ਹੈ ਇਸ ਕਲਾ ਵਿੱਚ ਚਿੱਤਰਕਾਰੀ ਵੀ ਇੱਕ ਕਲਾ ਹੈ ਮੈਂ ਇੱਕ ਵਾਰ ਚਿੱਤਰਕਾਰੀ ਦੀ ਕਲਾਸ ਲਗਾਈ ਸੀ ਚਿੱਤਰਕਾਰੀ ਮਨੁੱਖ ਦੇ ਭਾਵ ਨੂੰ ਚਿੱਤਰ ਵਿੱਚ ਵਿਖਾਉਣ ਦੀ ਇੱਕ ਕਲਾ ਹੈ ਜਦੋਂ ਮੈਂ ਚਿੱਤਰਕਾਰੀ ਦੀ ਕਲਾਸ ਲਗਾਈ ਤਾਂ ਉਸ ਕਲਾਸ ਵਿੱਚ ਉਹਨਾਂ ਨੇ ਸਾਨੂੰ ਵੱਖ ਵੱਖ ਤਰ੍ਹਾਂ ਦੀ ਚਿੱਤਰਕਾਰੀ ਕਰਨੀ ਸਿਖਾਈ ਉਸ ਕਲਾਸ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਸਾਨੂੰ ਜਾਨਵਰ ਦੀ ਚਿੱਤਰਕਾਰੀ ਕਰਨੀ ਸਿਖਾਈ ਫਿਰ ਅਸੀਂ ਫੁੱਲ ਬੂਟੇ ਦੀ ਚਿੱਤਰਕਾਰੀ ਕਰਨੀ ਸਿੱਖੀ ਉਸ ਉੱਪਰ ਉਸ ਚਿੱਤਰਕਾਰੀ ਵਿੱਚ ਉਹਨਾਂ ਨੇ ਸਾਨੂੰ ਅਲੱਗ ਅਲੱਗ ਰੰਗਾਂ ਨੂੰ ਮਿਲਾ ਕੇ ਕਿਵੇਂ ਨਵਾਂ ਰੰਗ ਬਣਦਾ ਹੈ ਉਹ ਸਾਨੂੰ ਚਿੱਤਰਕਾਰੀ ਵਿੱਚ ਪਤਾ ਲੱਗਿਆ ਜਿਵੇਂ ਸਫੇਦ ਅਤੇ ਕਾਲਾ ਰੰਗ ਮਿਲਾ ਕੇ ਨਵਾਂ ਰੰਗ ਸਲੇਟੀ ਬਣਦਾ ਹੈ ਚਿੱਤਰਕਾਰੀ ਵਿੱਚ ਉਹਨਾਂ ਨੇ ਸਾਨੂੰ ਪਹਾੜ ਨਦੀ ਆਦਿ ਦੇ ਚਿੱਤਰ ਕਿਵੇਂ ਬਣਾਏ ਜਾਂਦੇ ਹੈ ਅਤੇ ਇਸ ਵਿੱਚ ਕਿਸ ਕਿਸ ਤਰ੍ਹਾ ਦੇ ਰੰਗ ਭਰੇ ਜਾਂਦੇ ਹੈ ਚਿੱਤਰਕਾਰੀ ਦੀ ਚਿੱਤਰਕਾਰੀ ਕਰਨਾ ਵੀ ਇੱਕ ਕਲਾ ਹੀ ਨਹੀਂ ਹੈ ਇਹ ਇੱਕ ਤਰ੍ਹਾਂ ਦਾ ਆਪਣੇ ਮਨ ਦੇ ਭਾਵ ਪ੍ਰਗਟ ਕਰਨ ਦਾ ਵੀ ਇੱਕ ਤਰੀਕਾ ਹੈ ਚਿੱਤਰਕਾਰ ਲੱਖ ਲੱਖ ਅਲੱਗ ਚਿੱਤਰਕਾਰੀ ਦੇ ਦੁਆਰਾ ਆਪਣੇ ਮਨ ਦੇ ਭਾਵ ਪ੍ਰਗਟ ਕਰ ਦਿੰਦਾ ਹੈ ਚਿੱਤਰਕਾਰੀ ਦੇ ਰਾਹੀਂ ਅਸੀਂ ਕਿਸੇ ਵਿਅਕਤੀ ਦਾ ਵੀ ਚਿੱਤਰ ਵੀ ਬਣਾ ਸਕਦੇ ਹਾਂ ਚਿੱਤਰਕਾਰੀ ਸਕੂਲਾਂ ਵਿੱਚ ਇੱਕ ਮੁੱਖ ਵਿਸ਼ੇ ਦੇ ਰੂਪ ਵਿੱਚ ਸਕੂਲਾਂ ਵਿੱਚ ਹਰ ਕਲਾਸ ਵਿੱਚ ਜ਼ਰੂਰੀ ਸਿਖਾਉਣੀ ਚਾਹੀਦੀ ਹੈ ਤਾਂ ਜੋ ਮਨੁੱਖ ਇਸ ਚਿੱਤਰਕਾਰੀ ਨੂੰ ਸਿੱਖ ਕੇ ਆਪਣਾ ਭਵਿੱਖ ਉਜਵਲ ਕਰ ਸਕੇ ਅਤੇ ਕਈ ਤਰ੍ਹਾਂ ਦੇ ਹੋਰ ਵੀ ਕੰਮ ਕਰ ਸਕੇ